ਕਿਸਾਨ ਜਾਂ ਪੋਲਟਰੀ ਪਾਰਕ ਇਹ ਆਪਣੇ ਟਰੇਨਿੰਗ ਵਿੱਚ ਸਿੱਖਦੇ ਹਨ ਕਿਵੇਂ ਪੋਲਟਰੀ ਫਾਰਮ ਦੀ ਟ੍ਰਾਂਸਪਟੇਸ਼ਨ ਕਰਨੀ ਹੈ ਅਤੇ ਆਂਡਿਆਂ ਨੂੰ ਸਹੀ ਥਾਂ ਤੱਕ ਪਹੁੰਚਾਉਣਾ ਹੈ ਤੇ ਕਿਵੇਂ ਪਹੁੰਚਾਉਣਾ ਹੈ ਪੋਲਟਰੀ ਫਾਰਮ ਬਣਾਉਣ ਦਾ ਵੀ ਉਨ੍ਹਾਂ ਨੂੰ ਟਰੇਨਿੰਗ ਵਿੱਚ ਹੀ ਸਿਖਾਇਆ ਜਾਂਦਾ ਹੈ ਤੇ ਕਿਵੇਂ ਬਣਾਉਣੇ ਹਨ ਅਤੇ ਪਲੋਟਰੀ ਫਾਰਮ ਵੀ ਹਵਾਦਾਰ ਹੋਣੇ ਚਾਈਂਦੇ ਹਨ ਪੋਲਟਰੀ ਫਾਰਮ ਬਣਾਉਣ ਸਮੇਂ ਸੂਰਜ ਦੀ ਡਿਰੈਕਸ਼ਨ ਦਾ ਵੀ ਧਿਆਨ ਰੱਖਣਾ ਚਾਹੀਂਦਾ ਕਿਉਂਕੀ ਜਿਆਦਾ ਸੁ ਧੁੱਪ ਆਉਣ ਕਰਕੇ ਪੋਲਟਰੀ ਫਾਰਮ ਵਿੱਚ ਟੈਂਪਰੇਚਰ ਮੈਨਟੈਨ ਕਰਨਾ ਔਖਾ ਹੋ ਜਾਂਦਾ ਹੈ ਜਿਸ ਕਾਰਨ ਜਾਨਵਰਾਂ ਨੂੰ ਨੁਕਸਾਨ ਹੋ ਜਾਂਦਾ ਹੈ ਇਸਤੋਂ ਇਲਾਵਾ ਪੋਲਟਰੀ ਫਾਰਮ ਲੇ ਦੇ ਆਪੋ ਆਪਣੇ ਉਤਪਾਦਾਂ ਨੂੰ ਜਿਵੇਂ ਕੀ ਆਂਡੇ ਜਾਂ ਮੀਟ ਨੂੰ ਸ਼ਹਿਰ ਤੱਕ ਪਹੁੰਚਾਉਣ ਲਈ ਸਾਰੇ ਵਧੀਆ ਸੜਕੀ ਸੁਵਿਧਾਵਾਂ ਦਾ ਹੋਣਾ ਜਰੂਰੀ ਹੁੰਦਾ ਹੈ ਇਸ ਤੋਂ ਇਲਾਵਾ ਵਧੀਆ ਸਾਧਨ ਵੀ ਹੋਣਾ ਚਾਹੀਂਦਾ ਹੈ ਜਿਵੇਂ ਕੀ ਮੁਰਗਿਆਂ ਨੂੰ ਢੋਣ ਵਾਲੀ ਟਰੱਕ ਜਾਂ ਵੈਨ ਦਾ ਹੋਣਾ ਚਾਹੀਂਦਾ ਹੈ ਤੇ ਆਂਡਿਆਂ ਨੂੰ ਰੱਖਣ ਲਈ ਵਧੀਆ ਟਰੇਆਂ ਦਾ ਵੀ ਹੋਣਾ ਜਰੂਰੀ ਹੁੰਦਾ ਹੈ